ਹਾਂਜੀ ਮੇਰੀ ਜਾਣਕਾਰੀ ਦੇ ਵਿੱਚ ਇੱਕ ਰਿਪੋਰਟ ਇਹੋ ਜਿਹੀ ਕਿ ਜਿਨਾਂ ਨੇ ਅਖਬਾਰ ਵਾਲਿਆਂ ਨੇ ਇੱਕ ਗਲਤ ਨਿਊਜ਼ ਛਾਪੀ ਉਹਨਾਂ ਨੂੰ ਕੁਝ ਜਾਣਕਾਰੀ ਨਾ ਹੋਣ ਕਰਕੇ ਵੀ ਪੈਸਿਆਂ ਦੇ ਹਿਸਾਬ ਕਿਤਾਬ ਦੇ ਵਿੱਚ ਉਹਨਾਂ ਨੇ ਗਲਤ ਨਿਊਜ਼ ਛਾਪੀ ਹੈ ਜਬ ਜਦ ਕਿ ਗੱਲ ਇਸ ਤਰ੍ਹਾਂ ਦੀ ਸੀਗੀ ਕਿ ਕੁੜੀ ਵਾਲੇ ਬਾਈਕ ਮੁੰਡਾ ਅਤੇ ਕੁੜੀ ਬਾਈਕ ਚਲਾ ਰਹੇ ਸੀ ਤੇ ਉਹਨਾਂ ਦਾ ਐਕਸੀਡੈਂਟ ਜਿਵੇਂ ਕਾਫੀ ਬੁਰੀ ਤਰੀਕੇ ਨਾਲ ਹੋਇਆ ਤੇ ਮੁੰਡੇ ਵਾਲੇ ਕਹਿ ਰਹੇ ਸੀ ਕਿ ਕੁੜੀ ਖੁਦ ਬਾਈਕ ਚਲਾਉਣਾ ਚਾਹ ਰਹੀ ਸੀ ਪਰ ਉਥੋਂ ਦੇ ਜਿਹੜੇ ਲੋਕ ਸੀਗੇ ਉਹਨਾਂ ਨੇ ਜੋ ਕੁਝ ਵੀ ਵੇਖਿਆ ਕਿ ਕੁੜੀ ਬਾਈਕ ਚਲਾ ਨਹੀਂ ਰਹੀ ਸੀ ਮੁੰਡਾ ਹੀ ਬਾਇਕ ਚਲਾ ਰਿਹਾ ਸੀ ਤੇ ਉਹ ਕਹਿ ਰਹੇ ਸੀ ਕਿ ਮੁੰਡੇ ਨੇ ਨਸ਼ਾ ਕੀਤਾ ਹੋਇਆ ਤੇ ਉਥੋਂ ਫਿਰ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਤੇ ਪੁਲਿਸ ਵਾਲੇ ਉਥੋਂ ਆਏ ਤੇ ਉਹਨਾਂ ਨੂੰ ਐਬੂਲੈਂਸ ਦੇ ਵਿੱਚ ਲੈ ਕੇ ਗਏ ਸਰਕਾਰੀ ਹੋਸਪੀਟਲ ਦਾਖਿਲ ਕਰਾਇਆ ਗਿਆ ਉਥੇ ਜਾਂਚ ਪੜਤਾਲ ਕੀਤੀ ਗਈ ਵੀ ਪੁਲਿਸ ਵਾਲਿਆਂ ਦੀ ਗਲਤੀ ਹੈ ਜਾਂ ਅਖਬਾਰ ਵਾਲੇ ਦੀ ਗਲਤੀ ਪਰ ਉਸ ਤੋਂ ਬਾਅਦ ਫਿਰ ਜਿਹੜੀ ਵੀ ਜਾਂਚ ਪੜਤਾਲ ਸਾਹਮਣੇ ਆਈ ਉਹਦੇ ਵਿੱਚ ਪੁਲਿਸ ਵਾਲਿਆਂ ਨੇ ਕੁੜੀ ਵਾਲੇ ਨੂੰ ਇਨਸਾਫ ਦਿਲਾਇਆ ਤੇ ਉਸ ਤੋਂ ਬਾਅਦ ਫਿਰ ਕੁੜੀ ਵਾਲੀ ਦੀ ਕਾਰ ਮਤਲਬ ਕਿ ਜੋ ਵੀ ਉਹਨਾਂ ਦੇ ਤਰਫੋਂ ਇਨਸਾਫ ਕਰਾਇਆ ਗਿਆ ਕੁੜੀ ਵਾਲਿਆਂ ਨਾਲ